ਮੈਨੂੰ ਪਹਾੜੀ ਇਲਾਕਿਆਂ ਵਿੱਚ ਘੁੰਮਣਾ ਬਹੁਤ ਪਸੰਦ ਹੈ ਮੈਂ ਬਹੁਤ ਸਾਰੇ ਪਹਾੜੀ ਇਲਾਕੇ ਵਿਜ਼ਿਟ ਕੀਤੇ ਹਨ ਜਿਵੇਂ ਕਿ ਸ਼ਿਮਲਾ ਕੁੱਲੂ ਮਨਾਲੀ ਦੇਹਰਾਦੂਨ ਮਸੂਰੀ ਕਸੌਲੀ ਥੋੜ੍ਹੇ ਦਿਨ ਪਹਿਲਾਂ ਹੀ ਸਾਨੂੰ ਦੇਹਰਾਦੂਨ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਇੱਕ ਰਾਤ ਅਸੀਂ ਦੇਹਰਾਦੂਨ ਰੁਕੇ ਉਸ ਤੋਂ ਬਾਅਦ ਅਸੀਂ ਮਸੂਰੀ ਲਈ ਚਲੇ ਗਏ ਮਸੂਰੀ ਅਸੀਂ ਦੋ ਦਿਨ ਰਹੇ ਸਾਡਾ ਹੋਟਲ ਬਹੁਤ ਹੀ ਸੋਹਣਾ ਸੀ ਅਤੇ ਅ ਹੋਟਲ ਦੇ ਵਿੱਚ ਬਾਲਕਨੀ ਦਾ ਵਿਊ ਬਹੁਤ ਹੀ ਵਧੀਆ ਸੀ ਹੋਟਲ ਦਾ ਖਾਣਾ ਸਾਫ਼ ਸਫਾਈ ਸਭ ਕੁਛ ਬਹੁਤ ਵਧੀਆ ਸਨ ਅਸੀਂ ਰੈਸਟ ਕਰਨ ਤੋਂ ਬਾਅਦ ਮਸੂਰੀ ਮੋਲ ਦੇ ਉੱਤੇ ਘੁੰਮੇ ਅਤੇ ਕੁਛ ਸ਼ੋਪਿੰਗ ਵੀ ਕੀਤੀ ਉਸ ਤੋਂ ਅਗਲੇ ਦਿਨ ਅਸੀਂ ਦਨੋਲਟੀ ਚਲੇ ਗਏ ਦਨੋਲਟੀ ਇੱਕ ਬਹੁਤ ਹੀ ਨੇਚਰ ਕਲੋਜ ਜਗ੍ਹਾ ਹੈ ਸਾਨੂੰ ਬਰਫ਼ ਦੇ ਨਾਲ ਢੱਕੀਆਂ ਹੋਈਆਂ ਪਹਾੜੀਆਂ ਦਿੱਖ ਰਹੀਆਂ ਸੀ ਹਰਿਆਲੀ ਦਿੱਖ ਰਹੀ ਸੀ ਲੰਬੇ ਲੰਬੇ ਚਿਨਾਰ ਦੇ ਪੇੜ ਦਿੱਖ ਰਹੇ ਸੀ ਅਸੀਂ ਉੱਥੇ ਸੜਕ ਦੇ ਸਾਈਡ 'ਤੇ ਬੈਠ ਕੇ ਸੀ ਸਾਈਟਸੀਨ ਇੰਜੋਏ ਕੀਤਾ ਬਹੁਤ ਠੰਡਾ ਮੌਸਮ ਸੀ ਸਾਨੂੰ ਠੰਡ ਲੱਗਣ ਲੱਗ ਗਈ ਸੀ ਫਿਰ ਅਸੀਂ ਆਪਣੇ ਬੈਗ ਦੇ ਵਿੱਚੋਂ ਸਵੈਟਰ ਕੱਢ ਕੇ ਸਵੈਟਰ ਪਾਏ ਅਤੇ ਉਸ ਜਗ੍ਹਾ ਦਾ ਆਨੰਦ ਮਾਣਿਆ ਥੋੜ੍ਹਾ ਅੱਗੇ ਜਾਣ 'ਤੇ ਕੁਛ ਉੱਥੇ ਰੋਡ ਸਾਈਡ 'ਤੇ ਗੇਮਸ ਖੇਡ ਰਹੇ ਸੀ ਫਿਰ ਅਸੀਂ ਉਹ ਗੇਮਸ ਜਿਵੇਂ ਕਿ ਰੋਪਵੇਅ ਅਤੇ ਅ ਜ਼ਿੱਪਲਾਈਨ ਵਗੈਰਾ ਵੀ ਕੀਤੀ ਮੇਰੇ ਬੱਚਿਆਂ ਨੇ ਉੱਥੇ ਸਾਈਡ 'ਤੇ ਕੁਲਚੇ ਖਾਧੇ ਅਤੇ ਉੱਥੇ ਦਾ ਲੋਕਲ ਫੂਡ ਬਹੁਤ ਇੰਜੋਏ ਕੀਤਾ ਸਾਨੂੰ ਦਨੋਲਟੀ ਬਹੁਤ ਹੀ ਮਜ਼ਾ ਆਇਆ ਸਾਡਾ ਰੂਮ ਬਹੁਤ ਹੀ ਕੰਫਰਟੇਬਲ ਸੀ ਠੰਡ ਰਾਤ ਨੂੰ ਬਹੁਤ ਜ਼ਿਆਦਾ ਹੋ ਗਈ ਸੀ ਅਸੀਂ ਰਾਤ ਨੂੰ ਬੂਨਫਾਇਰ ਕੀਤੀ ਅਤੇ ਕੁਛ ਗਾਣੇ ਗਾਏ ਡਾਂਸ ਵੀ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਸੌ ਗਏ ਅਗਲੇ ਦਿਨ ਅਸੀਂ ਬ੍ਰੇਕਫਾਸਟ ਕਰਕੇ ਆਪਣੇ ਘਰ ਵਾਪਸ ਲਈ ਨਿਕਲ ਗਏ